ਹੈਲੋ ਹਾਂਜੀ ਨਮਸਤੇ ਜੀ ਹਾਂਜੀ ਹਾਂਜੀ ਹਾਂਜੀ ਹਾਂ ਮੈਮ ਇੱਥੋਂ ਦੇ ਹਾਂਜੀ ਹਾਂਜੀ ਹਾਂਜੀ ਆਹ ਪਿੰਡਾਂ ਦਾ ਰਹਿਣ ਸਹਿਣ ਮੈਮ ਬਹੁਤ ਵਧੀਆ ਵਾ ਆਪਣੇ ਉਹਨਾਂ ਦੀਆਂ ਜਗ੍ਹਾ ਜ਼ਮੀਨਾਂ ਹੁੰਦੀਆਂ ਘਰ ਦੀ ਖੇਤੀ ਹੁੰਦੀ ਘਰ ਦੀਆਂ ਸਬਜ਼ੀਆਂ ਹੁੰਦੀਆਂ ਵਧੀਆ ਖਾਂਦੇ ਹੈ ਵਧੀਆ ਪੀਂਦੇ ਹੈ ਸਿਹਤ ਵੀ ਚੰਗੀ ਹੈ ਉਹਨਾਂ ਦੀ ਪਿੰਡਾਂ ਦਾ ਰਹਿਣਾ ਸਾਫ ਸੁਥਰਾ ਵਾਤਾਵਰਨ ਹੈ ਉੱਥੋਂ ਵਧੀਆ ਵਧੀਆ ਤਰੀਕੇ ਨਾਲ ਰਹਿੰਦੇ ਹੈ ਸਾਰੇ ਉੱਥੇ ਹਾਂਜੀ ਘਰੋਂ ਹੀ ਸਬਜ਼ੀਆਂ ਤੋੜ ਕੇ ਉਹੀ ਬਣਾਉਂਦੇ ਹੈ ਬਿਨਾ ਖਾਦ ਤੋਂ ਔਰਗੈਨਿਕ ਹਾਂ ਹੋਰ ਜਗ੍ਹਾ ਜ਼ਮੀਨਾਂ ਵੀ ਕਾਫੀ ਹੁੰਦੀਆਂ ਵਾ ਉੱਥੋਂ ਘਰ ਦੀਆਂ ਗਾਈਆਂ ਮੱਝਾਂ ਵੀ ਹੁੰਦੀਆਂ ਵਾ ਦੁੱਧ ਦਹੀਂ ਵੀ ਘਰ ਦਾ ਘਰ ਦਾ ਲਵੇਰਾ ਹੁੰਦਾ ਵਾ ਜ਼ਿਆਦਾਤਰ ਬਿਮਾਰ ਨਹੀਂ ਹੁੰਦੇ ਵਧੀਆ ਵਧੀਆ ਚੀਜ਼ਾਂ ਖਾਂਦੇ ਹੈ ਪਿੰਡ ਦੇ ਪਿੰਡਾਂ ਦਾ ਵਾਤਾਵਰਨ ਤਾਂ ਬਹੁਤ ਵਧੀਆ ਇੱਥੋਂ ਦਾ ਹੋਰ ਦੱਸੋ ਪ ਪਹਿਰਾਵਾ ਵੀ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਉਹਨਾਂ ਦਾ ਸਾਰਿਆਂ ਦੀ ਇੱਜ਼ਤ ਕਰਦੇ ਆਏ ਗਏ ਦੀ ਹਾਂਜੀ ਔਰ ਰਹਿਣ ਸਹਿਣ ਵਧੀਆ ਖੁੱਲ੍ਹੀਆਂ ਹਵਾਵਾਂ ਵਿਹੜੇ 'ਚ ਮੰਜੇ ਡਾਹੋ ਸਾਰਾ ਦਿਨ ਉੱਥੇ ਬੈਠੋ ਆਪਣੇ ਪੇੜਾਂ ਥੱਲੇ ਬੈਠੋ ਜਿੱਥੇ ਮਰਜ਼ੀ ਬੈਠੋ ਖੁੱਲ੍ਹਾ ਵਾਤਾਵਰਨ ਹੈ ਸਾਰਾ ਵਧੀਆ ਵਧੀਆ ਤਰੀਕੇ ਨਾਲ ਰਹਿੰਦੇ ਹੈ ਮਹਿਮਾਨਾਂ ਦੀਆਂ ਦੇਖਭਾਲ ਵੀ ਵਧੀਆ ਕਰਦੇ ਹੈ ਸਾਰਿਆਂ ਸਾਰਾ ਵਧੀਆ ਵਾ ਪਿੰਡਾਂ ਦਾ ਪਿੰਡਾਂ ਦਾ ਰਹਿਣ ਬਹੁਤ ਵਧੀਆ ਹਾਂਜੀ ਆਇਓ ਕਦੀ ਪਿੰਡ ਤੁਹਾਨੂੰ ਦੱਸਾਂਗੇ ਘਰ ਪਹਿਰਾਵਾ ਹਾਂ ਬਹੁਤ ਵਧੀਆ ਪਹਿਰਾਵਾ ਵੀ ਸਾਦਾ ਪਹਿਰਾਵਾ ਉਹਨਾਂ ਦਾ ਸਲਵਾਰ ਕਮੀਜ਼ ਕਾਫੀ ਵਧੀਆ ਸਾਰਾ ਤਰੀਕਾ ਵਧੀਆ ਉਹਨਾਂ ਦਾ ਹਾਂ ਓਕੇ ਜੀ ਹਾਂਜੀ ਓਕੇ ਓਕੇ